ਪੰਜਾਬੀ ਨੂੰ ਵਿਆਕਰਨ ਦੇ ਵਿੱਚ ਲਿਖਣ ਦਾ ਬਹੁਤ ਹੀ ਵੱਡਾ ਹੱਥ ਹੈ ਜਿਵੇਂ ਕਿ ਵਿਆਕਰਨ ਦੇ ਵਿੱਚ ਜਿਹੜੇ ਚਿੰਨ੍ਹ ਹੁੰਦੇ ਨੇ ਕਿ ਜਿਵੇਂ ਕਿ ਬਿੰਦੀ ਹੋ ਗਈ ਕੌਮਾ ਹੋ ਗਿਆ ਕੌਮਾ ਜਿਹੜਾ ਹੈਗਾ ਲਾਈਨ ਰੁਕਣ ਦੇ ਲਈ ਵਰਤਿਆ ਜਾਂਦਾ ਹੈਗਾ ਹੈਗਾ ਅਤੇ ਡੰਡੀ ਹੁੰਦੀ ਹੈਗੀ ਉਹ ਜਿੱਥੇ ਲਾਈਨ ਖਤਮ ਹੁੰਦੀ ਹੈਗੀ ਉਸ ਤਰ੍ਹਾਂ ਵਰਤਿਆ ਜਾਂਦਾ ਹੈ ਜਿਵੇਂ ਪਰ ਪੰਜਾਬ ਪੰਜਾਬ 'ਚ ਦਫਤਰ ਸਕੂਲਾਂ 'ਚ ਮੀਡੀਆ 'ਚ ਪੰਜਾਬੀ ਨੂੰ ਗੁਰੂ ਗੁਰਮੁਖੀ ਲਿਪੀ ਵਿੱਚ ਵੀ ਲਿਖਿਆ ਜਾਂਦਾ ਹੈ ਗੁਰਮੁਖੀ ਪੰਜਾਬੀ ਦੇ ਲਈ ਅਧਿਕਾਰਤ ਮਿਆਰੀ ਲਿਪੀ ਹੈ ਹਾਲਾਂਕਿ ਅਕਸਰ ਵੀ ਗੈਰ ਅਧਿਕਾਰਤ ਤੌਰ 'ਤੇ ਲਾਤੀਨੀ ਲਿੱਪੀਆਂ 'ਚ ਲਿਖੀ ਜਾਂਦੀ ਹੈਗੀ ਜੋ ਸੰਘ ਪੱਧਰ 'ਤੇ ਭਾਰਤ 'ਚ ਦੋ ਪ੍ਰਾਇਮਰੀ ਸਰਕਾਰੀ ਭਾਸ਼ਾਵਾਂ 'ਚੋ ਇੱਕ ਹੈਗੀ ਜਿਹੜੀ ਗੁਰਮੁਖੀ ਲਿਪੀ ਹੈਗੀ ਭਾਰਤੀ ਵਿੱਚ ਜਿਹੜੀ ਪੰਜਾਬੀ ਵਿਸ਼ੇਸ਼ ਗੁਰਮੁਖੀ ਲਿਪੀ ਗੁਰਮੁਖੀ ਹੈ ਉਹ ਲਿਪੀ ਵਿੱਚ ਲਿਖੀ ਜਾਂਦੀ ਹੈ ਜਿਹੜੀ ਕਿ ਇੱਕ ਜੂਨ ਦੇ ਇੱਕ ਜੂਨ ਨੂੰ ਮਨਾਈ ਜਾਂਦੀ ਹੈ ਜੋ ਜਿਹੜੀ ਕਿ ਸਿੱਖਾਂ ਦੇ ਨਾਲ ਜੁੜੀ ਹੋਈ ਹੈ ਜਿਵੇਂ ਕਿ ਕਿ ਲਿਖਣ ਦੇ ਵਿੱਚ ਮੈਂ ਪਹਿਲਾਂ ਸਕੂਲ ਦੇ ਵਿੱਚ ਕੋਰਸ ਲਿਆ ਸੀਗਾ ਜਿੱਥੇ ਮੈਂ ਫਸਟ ਆਉਂਦੀ ਹੁੰਦੀ ਸੀ ਹਰ ਅਤੇ ਹਰੇਕ 'ਚ